ਹੈਲੋ ਸਤਿ ਸ਼੍ਰੀ ਅਕਾਲ ਸਰ ਤੁਸੀਂ ਗੁਰਦੁਆਰਾ ਸਾਹਿਬ ਦੇ ਮੈਨੇਜਰ ਸਾਹਿਬ ਬੋਲਦੇ ਪਏ ਤਰਨ ਤਾਰਨ ਤੋਂ ਅਸੀਂ ਨਾ ਤਰਨ ਤਾਰਨ ਘੁੰਮਣ ਆਉਣਾ ਏ ਆ ਆਪਣੇ ਬੱਚਿਆਂ ਦੇ ਨਾਲ ਅਤੇ ਤਰਨ ਤਾਰਨ ਅਸੀਂ ਕਿਸੇ ਇਤਿਹਾਸਿਕ ਗੁਰਦੁਆਰਾ ਦੇ ਤਰਨ ਤਾਰਨ ਦੇ ਦਰਸ਼ਨ ਕਰਨਾ ਚਾਹੁੰਦੇ ਹਾਂ ਅਤੇ ਸਾਨੂੰ ਤੁਸੀਂ ਇਸ ਗੁਰਦੁਆਰੇ ਦੇ ਇਤਿਹਾਸ ਬਾਰੇ ਦੱਸ ਸਕਦੇ ਹੋ ਬੱਚਿਆਂ ਨੂੰ ਵੀ ਹਾਂਜੀ ਹਾਂਜੀ

ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਰਾਤ ਰਹਿਣ ਦੀ ਵਿਵਸਥਾ ਹੈਗੀ ਆ ਹਾਂਜੀ ਠੀਕ ਆ ਧੰਨਵਾਦ ਮੈਨੇਜਰ ਸਾਹਿਬ ਠੀਕ